ਨਮਸਤੇ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਅੱਜ ਮੈਂ ਪਾਣੀ ਦੇ ਵਿੱਚ ਤੈਰਨ ਵਾਲੇ ਬੱਚਿਆਂ ਦੇ ਬਾਰੇ ਦੱਸਦੀ ਹਾਂ ਜਦੋਂ ਕਿ ਅਸੀਂ ਪਾਣੀ ਵਿੱਚ ਤੈਰੀ ਲਾਉਂਦੇ ਹਾਂ ਜਾਂ ਨਹਾਉਣ ਜਾਂਦੇ ਹਾਂ ਖੁੱਲ੍ਹੇ ਪਾਣੀ ਵਿੱਚ ਜਿੱਦਾਂ ਕਿ ਨਹਿਰ ਨਦੀ ਸੂਏ ਵਿੱਚ ਹੋ ਗਿਆ ਜਦੋਂ ਕਿ ਤੱਕ ਸਾਨੂੰ ਤੈਰਨਾ ਨਹੀਂ ਆਏ ਅਤੇ ਸਾਨੂੰ ਪਾਣੀ ਵਿੱਚ ਤੈਰਨ ਦੀ ਪਾਣੀ ਵਿੱਚ ਵੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਅਤੇ ਜਦੋਂ ਮਤਲਬ ਕਿ ਨਹਾਉਣ ਦੇ ਚਾਹਵਾਨ ਪਾਣੀ ਵਿੱਚ ਛਲਾਂਗ ਲਗਾ ਦਿੰਦੇ ਹਨ ਅਤੇ ਜਦੋਂ ਕਿ ਸਾਨੂੰ ਤੈਰੀ ਲਾਉਣਾ ਆਏ ਅਤੇ ਅਸੀਂ ਸਾਨੂੰ ਪਾਣੀ ਵਿੱਚ ਛਲਾਂਗ ਲਗਾਉਣੀ ਚਾਹੀਦੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਪੈਰ ਪਾਣੀ ਵਿੱਚ ਦੇਖ ਕੇ ਹੀ ਰੱਖਣਾ ਚਾਹੀਦਾ ਹੈ ਯਾਨੀ ਕਿ ਇੱਥੇ ਕਿ ਕੋਈ ਟਿੱਬਾ ਟੋਇਆ ਜਾਂ ਫਿਸਲਣ ਵਾਲੀ ਜਗ੍ਹਾ ਨਹੀਂ ਹੋਏ ਕਿਉੰਕਿ ਜਦੋਂ ਕੋਈ ਫਿਸਲਣ ਵਾਲੀ ਜਗ੍ਹਾ ਵਿੱਚ ਪੈਰ ਰੱਖਿਆ ਜਾਂਦਾ ਹੈ ਤਾਂ ਮਤਲਬ ਕਿ ਚੋਟ ਲੱਗਣ ਦਾ ਵੀ ਖਤਰਾ ਹੋ ਜਾਂਦਾ ਹੈ ਕਿ ਚੋਟ ਲੱਗਣ ਨਾਲ ਇਨਸਾਨ ਨੂੰ ਨੁਕਸਾਨ ਹੀ ਮਿਲਦਾ ਹੈ ਕਈ ਵਾਰੀ ਤਾਂ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ ਜਦੋਂ ਵੀ ਅਸੀਂ ਪਾਣੀ ਵਿੱਚ ਨਹਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕਿ ਪਾਣੀ ਵਾਲੀ ਟਿਊਬ ਦੇ ਮਤਲਬ ਕਿ ਕਾਰਨ ਸਾਨੂੰ ਥੋੜ੍ਹੀ ਜਿਹੀ ਸੁਰੱਖਿਆ ਮਿਲ ਜਾਂਦੀ ਹੈ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਹਰ ਕੰਮ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਧੰਨਵਾਦ ਜੀ